ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮਾਨਸਾ ਤੋਂ ਮੈਂ ਅੱਜ ਆਪਣਾ ਇੱਕ ਨਿੱਜੀ ਐਕਸਪੀਰੀਅੰਸ ਆ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਜਿਹੜਾ ਔਨਲਾਈਨ ਸ਼ਾਪਿੰਗ ਦਾ ਜ਼ਮਾਨਾ ਹਰ ਦੂਜਾ ਇਨਸਾਨ ਆਪਣੇ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੇ ਲਈ ਰੋਜ਼ਮੱਰਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਲਈ ਜਿਹੜੀ ਔਨਲਾਈਨ ਸ਼ਾਪਿੰਗ ਹੈ ਉਹਦੇ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਚੁੱਕਿਆ ਇੱਥੋਂ ਤੱਕ ਕਿ ਸਾਡੀ ਰਸੋਈ ਦੇ ਵਿੱਚ ਸਾਡੇ ਘਰ ਦੇ ਵਿੱਚ ਵਰਤੋਂ ਆਉਣ ਵਾਲੀਆਂ ਨਿੱਕੀ ਤੋਂ ਨਿੱਕੀ ਚੀਜ਼ ਦੇ ਲਈ ਅਸੀਂ ਔਨਲਾਈਨ ਸ਼ੋਪਿੰਗ ਦੇ ਉੱਪਰ ਜਿਹੜੇ ਨਿਰਭਰ ਆ ਉਹ ਪੂਰੀ ਤਰ੍ਹਾਂ ਹੋ ਚੁੱਕੇ ਹਾਂ ਬੇਸ਼ੱਕ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਔਨਲਾਈਨ ਸ਼ੋਪਿੰਗ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸੁਖਾਲਾ ਬਣਾ ਦਿੱਤਾ ਪਰ ਇਹਦੇ ਨਾਲ ਜਿਹੜੀਆਂ ਧੋਖੇ ਧੜੀਆਂ ਨੇ ਉਹ ਵੀ ਕਿਤੇ ਜ਼ਿਆਦਾ ਵੱਧ ਚੁੱਕੀਆਂ ਨੇ ਬੇਸ਼ੱਕ ਚੀਜ਼ਾਂ ਦੀ ਗਿਣਾਤਮਕਤਾ ਦੇ ਵਿੱਚ ਵਾਧਾ ਆਇਆ ਪਰ ਉਹਨਾਂ ਦਾ ਗੁਣਾਤਮਕ ਪੱਧਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਨੀਵਾਂ ਜਾ ਚੁੱਕਿਆ ਚੀਜ਼ਾਂ ਦੇ ਵਿੱਚ ਪਹਿਲਾਂ ਵਾਲੀ ਗੁਣਵੱਤਾ ਨਹੀਂ ਰਹੀ ਮੈਂ ਖੁਦ ਐਮਜ਼ੋਨ ਤੋਂ ਔਨਲਾਈਨ ਇੱਕ ਚਾਦਰ ਹੈ ਜਿਹੜੀ ਉਹ ਓਰਡਰ ਕੀਤੀ ਸੀਗੀ ਜਿਵੇਂ ਉਹਨਾਂ ਨੇ ਉਸ ਪ੍ਰੋਡਕਟ ਦੇ ਬਾਰੇ ਵਿੱਚ ਦਿਖਾਇਆ ਸੀਗਾ ਉਸ ਅਕੋਰਡਿੰਗ ਉਹ ਪ੍ਰੋਡਕਟ ਬਿਲਕੁਲ ਵੀ ਨਹੀਂ ਸੀਗਾ ਜਦ ਉਹ ਚਾਦਰ ਆਈ ਮੇਰੇ ਕੋਲ ਤਾਂ ਉਹ ਦੇਖਣ ਦੇ ਵਿੱਚ ਬਹੁਤ ਸੋਹਣੀ ਸੀ ਉਹਦਾ ਰੰਗ ਵੀ ਪੂਰੀ ਚੰਗੀ ਤਰ੍ਹਾਂ ਗੁਲਾਬੀ ਸੀਗਾ ਪਰ ਜਦੋਂ ਉਸਨੂੰ ਮੈਂ ਵਿਛਾ ਕੇ ਉਸ ਤੋਂ ਬਾਅਦ ਧੋਤਾ ਤਾਂ ਉਹਦੇ ਜਿਹੜਾ ਰੰਗ ਸੀਗਾ ਸਾਰੇ ਦਾ ਸਾਰਾ ਉਹ ਬਿਲਕੁਲ ਨਿਕਲ ਗਿਆ ਫੇਂਟ ਹੋ ਗਿਆ ਪੂਰੀ ਤਰ੍ਹਾਂ ਅਤੇ ਉਹ ਸੁੰਗੜ ਕੇ ਬਿਲਕੁਲ ਛੋਟੀ ਜਿਹੀ ਰਹਿ ਗਈ ਇੱਥੋਂ ਤੱਕ ਕਿ ਇੱਕ ਵਾਰ ਧੋਤੇ 'ਤੇ ਹੀ ਉਸ ਚਾਦਰ ਦੇ ਵਿੱਚੋਂ ਜਿਹੜੀਆਂ ਨੇ ਮੋਰੀਆਂ ਨਿਕਲ ਆਈਆਂ ਸੋ ਇੱਥੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਔਨਲਾਈਨ ਜਿਹੜਾ ਕੁਛ ਦਿਖਾਉਂਦੇ ਹੈਗੇ ਉਹ ਉਸ ਤਰ੍ਹਾਂ ਨਹੀਂ ਹੁੰਦਾ ਹੈਗਾ ਉਹਨਾਂ ਚੀਜ਼ਾਂ ਦੇ ਪਿੱਛੇ ਜਿਹੜੀ ਅਸਲ ਸੱਚਾਈ ਆ ਉਹ ਹੋਰ ਹੁੰਦੀ ਹੈ ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਬਹੁਤ ਜ਼ਿਆਦਾ ਸੁਚੇਤ ਹੋ ਕੇ ਉਹਨਾਂ ਚੀਜ਼ਾਂ ਨੂੰ ਖਰੀਦੋ ਧੰਨਵਾਦ